ਹੈਲੋ ਹੈਲੋ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਕੋਈ ਨਹੀਂ ਇੱਕ ਦੋ ਦਿਨ ਤੱਕ ਗੇੜਾ ਮਾਰ ਲੈਂਦੇ ਹੈ ਜੀ ਐਡਰੈੱਸ ਲਿਖਾ ਦਿਉ ਆਪਣਾ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ ਹੈ ਜੀ ਤੁਹਾਡਾ ਸ਼ੁਭ ਨਾਮ ਜੀ ਠੀਕ ਹੈ ਜੀ ਗੱਲ ਇਹ ਹੈ ਜੀ ਦੇਖੋ ਮੌਸਮ ਗਰਮੀਆਂ ਦਾ ਚੱਲ ਰਿਹਾ ਲੋਕਾਂ ਦੇ ਪੱਖੇ ਫ਼ਰਿੱਜ ਵਗੈਰਾ ਵੀ ਖ਼ਰਾਬ ਹੋਏ ਹੋਏ ਹੈ ਤਾਂ ਕਰਕੇ ਥੋੜ੍ਹਾ ਜਿਹਾ ਦੋ ਤਿੰਨ ਦਿਨ ਲੱਗ ਜਾਣਗੇ ਮੈਂ ਮੁੰਡਾ ਭੇਜ ਦੂੰਗਾ ਠੀਕ ਹੈ ਜੀ ਜਿਵੇਂ ਵੀ ਫ਼ਰੀ ਹੁੰਦਾ ਮੁੰਡਾ ਅਤੇ ਦੋ ਕੁ ਦਿਨ ਤਾਂ ਲੱਗ ਹੀ ਜਾਣਗੇ ਜੀ ਠੀਕ ਹੈ ਜੀ ਚਲੋ ਠੀਕ ਹੈ ਮੈਂ ਕੱਲ੍ਹ ਦੇਖਦਾ ਅੱਜ ਤਾਂ ਨਹੀਂ ਅੱਜ ਤਾਂ ਕਿਤੇ ਮੈਂ ਬਾਹਰ ਆਇਆ ਹੋਇਆ ਅਤੇ ਲੇਬਰ ਗਏ ਹੋਏ ਬੰਦੇ ਵੀ ਮਕੈਨਿਕ ਵੀ ਅਤੇ ਕੱਲ੍ਹ ਕਰਵਾਉਣ ਦੀ ਮੈਂ ਪੂਰੀ ਕੋਸ਼ਿਸ਼ ਕਰਦਾ ਜੀ ਠੀਕ ਹੈ ਜੀ ਫ਼ੋਨ ਨੰਬਰ ਤੁਹਾਡਾ ਇਹ ਹੀ ਹੈ ਨਾ ਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਕੋਈ ਨਾ ਜੀ ਮੈਂ ਜਲਦੀ ਇਹ ਤਾਂ ਹੁਣ ਖੋਲ੍ਹ ਕੇ ਪਤਾ ਲੱਗੇਗਾ ਜੀ ਵੀ ਮੋਟਰ ਦੀ ਪ੍ਰੋਬਲਮ ਹੈ ਜਾਂ ਕੋਈ ਹੋਰ ਹੈ ਦੀ ਹੈਗੀ ਬਾਕੀ ਢਾਈ ਸੌ ਰੁਪਏ ਹੈਗੇ ਹੈ ਚੈੱਕ ਕਰਨ ਦੇ ਜੇ ਕੋਈ ਪਾਰਟਸ ਪਿਆ ਤਾਂ ਉਹ ਅਲੱਗ ਹੈਗੇ ਹੈ ਜੀ ਹਾਂਜੀ ਹਾਂਜੀ ਓਕੇ ਜੀ ਠੀਕ ਹੈ